ਮੈਨੂੰ ਯਾਤਰਾ ਕਰਨੀ ਬਹੁਤ ਜ਼ਿਆਦਾ ਪਸੰਦ ਹੈ ਮੈਂ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਜਿਨਾਂ ਵਿੱਚੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਇੱਦਾਂ ਦਾ ਸੀ ਜਿ ਜਿਸ ਨਾਲ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਮੈਂ ਸਭ ਤੋਂ ਸਭ ਤੋਂ ਵਧੀਆ ਯਾਤਰਾ ਮੇਰੀ ਨੈਣਾਂ ਦੇਵੀ ਦੀ ਰਹੀ ਹੈ ਇੱਥੇ ਦੀ ਯਾਤ ਇੱਥੇ ਮਾਤਾ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ ਇੱਥੇ ਦਾ ਸੂਰਜ ਸ਼ਾਮ ਨੂੰ ਡੁੱਬਦਾ ਸੂਰਜ ਦੇਖ ਕੇ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਵਾਲਾ ਅਨੁਭਵ ਹੁੰਦਾ ਹੈ ਜਦੋਂ ਮਾਤਾ ਦੇ ਦਰਸ਼ਨ ਕਰਨ ਦੇ ਲਈ ਬਹੁਤ ਸਾਰੀ ਯਾਤਰਾ ਕਰਨੀ ਪੈਂਦੀ ਹੈ ਪੈਦਲ ਯਾਤਰਾ ਮੈਨੂੰ ਜ਼ਿਆਦਾਤਰ ਪੈਦਲ ਯਾਤਰਾ ਕਰਨੀ ਪਸੰਦ ਹੈ ਜਿਸ ਦੇ ਲਈ ਬਹੁਤ ਬਹੁਤ ਮਾਤਾ ਦੇ ਦਰਸ਼ਨ ਕਰਨ ਦੇ ਲਈ ਬਹੁਤ ਉੱਚੀ ਚੜ੍ਹਾਈ 'ਤੇ ਜਾਣਾ ਪੈਂਦਾ ਹੈ ਔਰ ਉਸ ਦੇ ਲਈ ਬਹੁਤ ਸਾਰੀਆਂ ਪੌੜੀਆਂ ਵੀ ਹੈ ਔਰ ਉਹ ਪੌੜੀਆਂ ਚੜ੍ਹ ਕੇ ਮ ਮਨ ਦੇ ਵਿੱਚ ਮਾਤਾ ਦੀ ਸ਼ਰਧਾ ਦੇ ਬਾਰੇ ਵਿੱਚ ਮੈਨੂੰ ਬਹੁਤ ਸਾਰਾ ਪਤਾ ਲ ਪਤਾ ਲੱਗਿਆ ਕਿ ਮੇਰੇ ਲਿ ਮਨ ਵਿੱਚ ਮਾਤਾ ਰਾਣੀ ਦੇ ਲਈ ਕਿੰਨੀ ਜ਼ਿਆਦਾ ਸ਼ਰਧਾ ਹੈ ਅਤੇ ਬਹੁਤ ਸਾਰਾ ਪਿਆਰ ਹੈ ਅਤੇ ਮੈਨੂੰ ਇਸ ਯਾਤਰਾ ਵਿੱਚ ਮਾਤਾ ਰਾਣੀ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ